ਘੋੜ ਸਵਾਰੀ ਕਰਦੇ ਸਮੇਂ ਸਭ ਤੋਂ ਪਹਿਲਾਂ ਘੋੜਾ ਬੀਮਾਰ ਨਹੀਂ ਹੋਣਾ ਚਾਹੀਦਾ ਇੱਕ ਤੰਦਰੁਸਤ ਘੋੜਾ ਹੀ ਤੁਹਾਨੂੰ ਵਧੀਆ ਰਾਈਡ ਦੇ ਸਕਦਾ ਹੈ ਦੂਜੇ ਨੰਬਰ 'ਤੇ ਘੋੜ ਸਵਾਰੀ ਕਰਦੇ ਸਮੇਂ ਕਾਠੀ ਨੂੰ ਹਮੇ ਬਹੁਤ ਹੀ ਵਧੀਆ ਢੰਗ ਨਾਲ਼ ਬੰਨ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ ਘੋੜੇ ਦੀ ਤੇਜ਼ ਗਤੀ ਸਮੇਂ ਤੁਸੀਂ ਡਿੱਗ ਨਾ ਜਾਵੋ ਤੀਜਾ ਘੋੜ ਸਵਾਰੀ ਕਰਨ ਸਮੇਂ ਹਮੇਸ਼ਾ ਰਾਹ ਸੌਖਾ ਚੁਣਨਾ ਚਾਹੀਦਾ ਹੈ ਤਾਂ ਕਿ ਕੰਡਿਆਂ ਜਾਂ ਗਲਤ ਉ ਉੱਗੜ ਦੁੱਗੜ ਰਾਹ ਵਿੱਚ ਤੁਸੀਂ ਡਿੱਗ ਨਾ ਜਾਵੋ ਘੋੜ ਸਵਾਰੀ ਕਰਦੇ ਸਮੇਂ ਇਸ ਗੱਲ ਦਾ ਵੀ ਵਧੀਆ ਧਿਆਨ ਰੱਖਣਾ ਚਾਹੀਦਾ ਹੈ ਕਿ ਘੋੜੇ ਨਾਲ਼ ਤੁਹਾਡਾ ਪਿਆਰ ਬੰਧਨ ਵਧੀਆ ਹੋਵੇ ਤਾਂ ਕਿ ਉਹ ਘੋੜ ਸਵਾਰੀ ਕਰਵਾਉਂਦੇ ਸਮੇਂ ਤੁਹਾਡੇ ਨਾਲ਼ ਅਣਸੁਖਾਵਾਂ ਮਹਿਸੂਸ ਨਾ ਕਰੇ